ਲੇਟੈਸਟ ਜਿਹੜੀ ਮੈਂ ਕਿਤਾਬ ਪੜ੍ਹੀ ਹੈਗੀ ਆ ਉਹਦਾ ਨਾਂ ਆ ਰਾਣੀ ਤੱਤ ਇਹ ਇੱਕ ਬਹੁਤ ਹੀ ਮਸ਼ਹੂਰ ਪੰਜਾਬੀ ਦੀ ਕਿਤਾਬ ਹੈ ਇਹਦੇ ਵਿੱਚ ਸ਼ਾਇਰੀ ਹੈ ਤੁਹਾਡੀਆਂ ਕਵਿਤਾਵਾਂ ਨੇ ਅਤੇ ਬਹੁਤ ਸਾਰੇ ਵਿਚਾਰ ਨੇ ਜਿਹੜੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਅਤੇ ਇਹ ਕਿਤਾਬ ਹਰਮਨਜੀਤ ਸਿੰਘ ਦੁਆਰਾ ਲਿਖੀ ਗਈ ਹੈ ਇਹ ਕਿਤਾਬ ਦੀਆਂ ਜਿਹੜੀਆਂ ਅਕਸਰ ਮੈਂ ਲਾਈਨਾਂ ਪੜ੍ਹਦੀ ਹੁੰਦੀ ਹਾਂ ਅਤੇ ਮੈਂ ਕਈ ਵਾਰ ਫੇਸਬੁੱਕ 'ਤੇ ਵੀ ਪੋਸਟ ਕਰ ਦਿੰਦੀ ਹੁੰਦੀ ਹਾਂ ਇਹ ਲਾਈਨਾਂ ਅਤੇ ਕੁਛ ਲਾਈਨਾਂ ਮੈਨੂੰ ਯਾਦ ਹੈ ਇਸ ਕਿਤਾਬ ਦੀਆਂ ਜਿਹੜੀਆਂ ਮੈਨੂੰ ਬਹੁਤ ਹੀ ਵਧੀਆ ਲੱਗਦੀਆਂ ਨੇ ਕਹਿੰਦੇ ਮਾਵਾਂ ਦੇ ਚਰਨ ਹੁੰਦੇ ਨੇ ਧੀਆਂ ਦੇ ਕਰਮ ਹੁੰਦੇ ਨੇ ਭੁੱਖੇ ਨੂੰ ਰੋਟੀ ਦੇ ਦਿਓ ਪਿਆਸੇ ਨੂੰ ਪਾਣੀ ਪਿਲਾ ਦਿਓ ਇਹੀ ਤਾਂ ਧਰਮ ਹੁੰਦੇ ਨੇ ਇਹ ਕਿਤਾਬ ਮਤਲਬ ਇੱਕ ਨਾ ਤੁਹਾਡੇ ਵਿੱਚ ਜਦੋਂ ਤੁਸੀਂ ਪੜ੍ਹਦੇ ਹੋ ਤੁਹਾਡੇ ਦਿਮਾਗ ਨੂੰ ਝੰਝੋੜ ਕੇ ਰੱਖ ਦਿੰਦੀ ਹੈ ਮਤਲਬ ਇਹਦੇ ਵਿੱਚ ਵਿਚਾਰਾਂ ਨੂੰ ਇਸ ਤਰੀਕੇ ਦੇ ਨਾਲ ਸੱਚਾਈ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਆ ਕਿ ਤੁਹਾਡਾ ਦਿਮਾਗ ਇੱਕ ਵਾਰੀ ਸੋਚਣ 'ਤੇ ਨਾ ਮਜਬੂਰ ਹੋ ਜਾਂਦਾ ਵੀ ਹਾਂ ਵੀ ਵਾਕਈ ਵੀ ਇੱਦਾਂ ਹੁੰਦਾ ਜੋ ਦੁਨੀਆਂ ਦੇ ਵਿੱਚ ਇੱਕ ਹੋਰ ਮੈਨੂੰ ਯਾਦ ਹੈ ਲਾਈਨਾਂ ਤੇਰੇ ਰਾਹਾਂ 'ਤੇ ਨੱਚਾਂਗੀ ਭਰੇ ਅਸਮਾਨ ਦੇ ਥੱਲੇ ਛਣਕ ਦੀ ਵੰਗ ਤੋਂ ਚੋਰੀ ਮੈਂ ਆਪਣੀ ਸੰਗ ਤੋਂ ਚੋਰੀ